ਹੈਲੋ ਹਾਂਜੀ ਹਾਂਜੀ ਬੂਸ ਬੂਸਟਰ ਕਲੱਬ ਹਾਂ ਕੋਆਰਡੀਨੇਟਰ ਈਸ ਹੇਅਰ ਗੁੱਡ ਈਵਨਿੰਗ ਸਰ

ਓਕੇ ਓਕੇ ਸਾਡੀ ਕੰਪਨੀ ਵਿੱਚ ਤੁਸੀਂ ਇਹ ਦੱਸ ਸਕਦੇ ਹੋ ਕਿ ਤੁਹਾਡਾ ਬੱਚਾ ਮੇਲ ਹੈ ਫੀਮੇਲ ਹੈ ਹਾਓ ਯੂਅਰ ਓਲਡ ਈਸ ਹੀ ਈਸ ਕਿੰਨੇ ਸਾਲ ਦਾ ਹੈ ਓਕੇ ਬਹੁਤ ਛੋਟੇ ਬੱਚਿਆਂ ਲਈ ਅਸੀਂ ਇੱਕ ਸਪੋਰਟਸ ਜਿਵੇਂ ਕਿ ਕ੍ਰਿਕਟ ਬਾਸਕਿਟਬੋਲ ਇਨਡੋਰ ਗੇਮਸ ਅਤੇ ਸਵਿਮਿੰਗ ਅਤੇ ਹੋਰ ਇਸ ਤਰ੍ਹਾਂ ਦੀਆਂ ਗੇਮਸ ਹੈ ਅਤੇ ਇਸ ਤੋਂ ਇਲਾਵਾ ਸਕੇਟਸ ਵਗੈਰਾ ਦੀ ਵੀ ਹੈ ਤੁਸੀਂ ਤੁਹਾਡਾ ਬੱਚਾ ਕਿਸ ਸਪੋਰਟਸ ਵਿੱਚ ਸਪੋਰਟਸ ਵਿੱਚ ਜਾਂ ਕਿਸੇ ਐਕਸਟਰਾ ਕਰੀਕੂਲਰ ਐਕਟੀਵਿਟੀ ਕੋਰਸ ਕਿਹੜੀ ਐਕਟੀਵਿਟੀ ਵਿੱਚ ਉਹ ਇੰਟਰਸਟ ਹੈ ਉਹਨੂੰ

ਨਹੀਂ ਪੇਰੈਂਟਸ ਨਾਲੋਂ ਜ਼ਿਆਦਾ ਬੱਚਾ ਹੀ ਦੱਸ ਸਕਦਾ ਵੀ ਉਹਦਾ ਇੰਟਰਸਟ ਕਿੱਧਰ ਹੈ ਅਤੇ ਉਹ ਦੇਖਕੇ ਫਿਰ ਤੁਸੀਂ ਬੱਚੇ ਨੂੰ ਜਿਹੜੀ ਵੀ ਸਪੋਰਟਸ ਕਹੋਗੇ ਉਸ ਸਪੋਰਟਸ 'ਚ ਆਪਾਂ ਉਹਨੂੰ ਪਰਮੀਸ਼ਨ ਦੇ ਦਿਆਂਗੇ ਤੁਸੀਂ ਫਿਰੋਜ਼ਪੁਰ ਤੋਂ ਹੀ ਹੋ

ਬਿਲਕੁਲ ਬਿਲਕੁਲ ਸਾਡੇ ਕੋਲ ਹਰ ਸਪੋਰਟਸ ਦਾ ਬਹੁਤ ਵਧੀਆ ਏਵਨ ਟਰੇਨਰ ਹੈ ਅਤੇ ਉਹ ਬਹੁਤ ਵਧੀਆ ਗਾਈਡ ਕਰਦਾ ਬੱਚਿਆਂ ਨੂੰ ਬਹੁਤ ਪਿਆਰ ਨਾਲ ਅਤੇ ਇੰਵਨਿੰਗ ਟਾਈਮ ਉਹ ਦੋ ਘੰਟੇ ਦਿੱਤੇ ਜਾਂਦੇ ਬੱਚਿਆਂ ਨੂੰ ਫਿਰ ਤੁਸੀਂ ਦੇਖ ਲਓ ਜਿਹੜਾ ਵੀ ਟਾਈਮ ਤੁਹਾਨੂੰ ਸੂਟ ਕਰਦਾ ਉਹ ਤੁਸੀਂ ਦੱਸ ਸਕਦੇ ਹੋ ਨਹੀਂ ਇਹ ਅਲੱਗ ਅਲੱਗ ਹੈ ਫੀਸ ਅਤੇ ਉਹ ਤੁਸੀਂ ਇੱਕ ਵਾਰੀ ਤੁਸੀਂ ਵਿਜ਼ਿਟ ਕਰੋ ਸਾਡੇ ਕਲੱਬ ਵਿੱਚ ਫਿਰ ਆਪਾਂ ਡਿਸਕਸ ਕਰਕੇ ਤੁਹਾਨੂੰ ਦੱਸਦੇ ਕੱਲ੍ਹ ਸ਼ਾਮ ਨੂੰ ਤੁਸੀਂ ਦੋ ਵਜੇ ਤੋਂ ਬਾਅਦ ਕਦੀ ਵੀ ਮਿਲ ਸਕਦੇ ਹੋ ਓਕੇ ਓਕ ਓਕੇ ਓਕੇ